ਹੈਲੋ ਸਤਿ ਸ਼੍ਰੀ ਅਕਾਲ ਜੀ ਹੈਲੋ ਹਾਂਜੀ ਮੈਮ ਅਸੀਂ ਨਾ ਘੁੰਮਣ ਵਾਸਤੇ ਆਉਣਾ ਹੈ ਜੀ ਹੈਲੋ ਹਾਂਜੀ ਤੁਸੀਂ ਗੁਰਦੁਆਰੇ ਤੋਂ ਬੋਲਦੇ ਹੋ ਜੀ ਹਾਂਜੀ ਅਸੀਂ ਨਾ ਘੁੰਮਣ ਵਾਸਤੇ ਆਉਣਾ ਹੈ ਜੀ ਅਤੇ ਸਾਨੂੰ ਦੱਸੋ ਇੱਥੇ ਕਮਰੇ ਕੁਮਰੇ ਵਧੀਆ ਵਧੀਆ ਹੈਗੇ ਆ ਜੀ ਕਿਵੇਂ ਆ ਸਾਫ਼ ਸਫ਼ਾਈ ਦੀ ਅੱਛਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਹੂੰ ਹੂੰ ਅੱਛਾ ਜੀ ਹਾਂਜ ਹਾਂਜੀ ਹਾਂਜੀ ਅੱਛਾ ਜੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਹੋਰ ਕੋਈ ਵਧੀਆ ਅ ਅੱਛਾ ਅੱਛਾ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਜੀ ਅੱਛਾ ਜੀ ਹੋਰ ਕੋਈ ਜੀ ਹੈਲੋ ਹਾਂਜੀ ਹੋਰ ਕੋਈ ਵਧੀਆ ਚੀਜ਼ ਕੋਈ ਦੇਖਣ ਵਾਸਤੇ ਹੈਲੋ ਹਾਂਜੀ ਹਾਂਜੀ ਨਹੀਂ ਉਹ ਤਾਂ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਆਵਾਂਗੇ ਜ਼ਰੂਰ ਆਵਾਂਗੇ ਜੀ ਹਾਂਜੀ ਹਾਂਜੀ ਹੈਲੋ ਹੈਲੋ ਆਵਾਜ਼ ਆਈ ਜਾਂਦੀ ਹੈ ਹਾਂਜੀ ਅੱਛਾ ਜੀ ਉਹ ਏ ਸੀ ਉ ਸੀ ਵਧੀਆ ਲੱਗੇ ਕਮਰੇ ਵਧੀਆ ਸਾਫ਼ ਸੂਫ ਹੈ ਜੀ ਅੱਛਾ ਜੀ ਅੱਛਾ ਠੀਕ ਹੈ ਜੀ ਅੱਛਾ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਹਾਂਜੀ ਹਾਂ ਅਸੀਂ ਬੱਚਿਆਂ ਨੂੰ ਛੁੱਟੀਆਂ 'ਚ ਲੈ ਕੇ ਆਉਣਾ ਅਸੀਂ ਕਿਹਾ ਘੁੰਮੀਏ ਫਿਰੀਏ ਕਿ ਥੋੜ੍ਹਾ ਬਹੁਤਾ ਵਿਖਾਈਏ ਬੱਚਿਆਂ ਨੂੰ ਵੀ ਠੀਕ ਹੈ ਜੀ ਓਕੇ ਸਤਿ ਸ਼੍ਰੀ ਅਕਾਲ